ਅੱਜ ਦਾ ਮਨੁੱਖ ਵਹਿਮਾਂ ਭਰਮਾਂ ਵਿੱਚ ਬਹੁਤ ਫਸਿਆ ਹੈ ਕਈ ਇਹੋ ਜਿਹੇ ਵਹਿਮ ਭਰਮ ਹਨ ਜਿਹੜੇ ਅਜੋਕੇ ਕਾਲ ਤੋਂ ਪੁਰਾਤਨ ਕਾਲ ਤੋਂ ਸਾਡੇ ਨਾਲ ਜੁੜੇ ਆਉਂਦੇ ਨੇ ਜਿਵੇਂ ਫਰਜ਼ ਕਰੋ ਬਰਾਤ ਜਾਣਾ ਹੈ ਤਾਂ ਕਹਿੰਦੇ ਨੇ ਕਿ ਕੋਈ ਕਾਲੀ ਬਿੱਲੀ ਰਸਤਾ ਕੱਟ ਜੇ ਤਾਂ ਅਸ਼ੁਭ ਹੁੰਦਾ ਹੈ ਲੋਕ ਇਹਨਾਂ ਗੱਲਾਂ ਵਿੱਚੋਂ ਅਜੇ ਤੱਕ ਵੀ ਨਿਕਲ ਨਹੀਂ ਸਕੇ ਅਤੇ ਕਈ ਵਹਿਮ ਭਰਮ ਮੁੱਢ ਤੋਂ ਹੀ ਸਾਡੇ ਨਾਲ ਚੱਲਦੇ ਆ ਰਹੇ ਨੇ ਲੋਕ ਇਸ ਵਿੱਚ ਇਹ ਇਹਨਾਂ ਕਰਮ ਕਾਂਡਾਂ ਅਤੇ ਵਹਿਮਾਂ ਦੇ ਵਿੱਚ ਫਸਦੇ ਜਾ ਰਹੇ ਨੇ ਇਹਨਾਂ 'ਚੋਂ ਲੋਕਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਵਿਸ਼ਵਾਸ ਕਰਕੇ ਆਪਣੇ ਮਾਰਗ ਤੋਂ ਭਟਕ ਜਾਂਦੇ ਨੇ ਸੋ ਇਹਨਾਂ ਵਹਿਮਾਂ ਭਰਮਾਂ ਵਿੱਚ ਆਪਾਂ ਨੂੰ ਫਸਣ ਦੀ ਜ਼ਰੂਰਤ ਨਹੀਂ ਅਤੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਇਹ ਵਹਿਮ ਭਰਮ ਸਾਡੀਆਂ ਰ ਮੰਜ਼ਿਲਾਂ ਦੇ ਵਿੱਚ ਰੁਕਾਵਟਾਂ ਪਾਉਂਦੇ ਹਨ ਧੰਨਵਾਦ